ਨਹੀਂ ਹਾਲੇ ਤੱਕ ਤਾਂ ਮੈਂ ਡਰੋਨ ਨਾਲ ਸ਼ੂਟਿੰਗ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਪਰ ਜੇਕਰ ਮੈਨੂੰ ਮੌਕਾ ਮਿਲੇ ਤਾਂ ਮੈਂ ਡਰੋਨ ਨਾਲ ਸ਼ੂਟਿੰਗ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਾ ਚਾਹਾਂਗਾ ਉਹ ਦੀ ਵਜ੍ਹਾ ਇਹ ਹੈ ਕਿ ਡਰੋਨ ਨਾਲ ਸ਼ੂਟਿੰਗ ਕਰਨਾ ਬਹੁਤ ਹੀ ਆਸਾਨ ਹੋ ਗਿਆ ਹੈ ਹਵਾਈ ਦ੍ਰਿਸ਼ਟੀਕੋਣ ਤੋਂ ਥੱਲੇ ਦਾ ਸ਼ੂਟ ਲੈਣਾ ਬਹੁਤ ਹੀ ਵਧੀਆ ਹੁੰਦਾ ਹੈ ਇਸ ਨਾਲ ਤਾਂ ਪਹਿਲਾਂ ਤਾਂ ਸ਼ੂਟ ਬਹੁਤ ਵਧੀਆ ਹੁੰਦਾ ਹੈ ਦੂਸਰਾ ਤਾਂ ਸਾਨੂੰ ਦੂਰ ਤੱਕ ਦੀ ਵੀ ਫੁਟੇਜ ਮਿਲ ਜਾਂਦੀ ਹੈ ਇਸ ਨਾਲ ਵਾਧਾ ਇਹ ਹੁੰਦਾ ਹੈ ਕਿ ਜੇਕਰ ਆਪਾਂ ਜਮੀਨ 'ਤੇ ਰਹਿ ਕੇ ਸ਼ੂਟਿੰਗ ਕਰਦੇ ਹਾਂ ਤਾਂ ਸਾਨੂੰ ਕੁਝ ਹੀ ਬੰਨਿਆਂ ਦੀ ਸ਼ੂਟਿੰਗ ਮਿਲ ਸਕਦੀ ਹੈ ਪਰ ਜੇਕਰ ਆਪਾਂ ਉਹ ਵੀ ਸ਼ੂਟਿੰਗ ਡਰੋਨ ਦੇ ਰਹੀ ਕਰਦੇ ਹਾਂ ਤਾਂ ਸਾਨੂੰ ਪੂਰੇ ਵਿਆਹ ਦੀ ਸ਼ੂਟ ਮਿਲ ਸਕਦੀ ਹੈ ਜੇਕਰ ਆਪਾਂ ਵਿਆਹ ਦੇ ਵਿੱਚ ਉਹ ਸ਼ੂਟ ਕਰ ਰਹੇ ਹਾਂ ਤਾਂ ਸਾਨੂੰ ਪੂਰੇ ਵਿਆਹ ਦੀ ਅਤੇ ਪੂਰੇ ਪੈਲਸ ਦੀ ਸ਼ੂਟ ਮਿਲ ਸਕਦੀ ਹੈ ਅਪ ਮੈਂ ਸੋਚਦਾ ਹਾਂ ਕਿ ਹਵਾਈ ਦ੍ਰਿਸ਼ਟੀਕੋਣ ਸਾਡੇ ਸੰਸਾਰ ਨੂੰ ਦੇਖਣ ਦੇ ਤਰੀਕੇ ਨੂੰ ਬਹੁਤ ਹੀ ਬਦਲ ਦਿੰਦਾ ਹੈ ਉਹ ਇਸ ਕਰਕੇ ਇੱਕ ਆਮ ਇਨਸਾਨ ਜਮੀਨ 'ਤੇ ਖਲੋ ਕੇ ਉੰਨੀ ਹੀ ਦੂਰ ਵੇਖ ਸਕਦਾ ਹੈ ਜਿੰਨੀਆਂ ਕਿ ਉਹਦੀਆਂ ਅੱਖਾਂ ਵੇਖ ਸਕਣ ਪਰ ਜੋ ਡਰੋਨ ਸਾਨੂੰ ਵਿਖਾ ਸਕਦਾ ਹੈ ਸਾਡੀਆਂ ਅੱਖਾਂ ਸਾਨੂੰ ਨਹੀਂ ਵਿਖਾ ਸਕਦੀਆਂ ਉਹ ਇਸ ਕਰਕੇ ਡਰੋਨ ਹਵਾ ਵਿੱਚ ਕਾਫ਼ੀ ਉੱਪਰ ਨੂੰ ਚਲਾ ਜਾਂਦਾ ਹੈ ਜਿਸ ਨਾਲ ਸਾਡੇ ਫੋਨ ਵਿੱਚ ਉਹਦੀ ਵੀਡੀਓ ਰਿਕਾਰਡ ਕਰਨ ਭੇਜਦਾ ਹੈ ਉਹ ਵੀਡੀਓ ਥਰੁ ਦੁਆਰਾ ਆਪਾਂ ਦੂਰ ਦੂਰ ਤੱਕ ਵੇਖ ਸਕਦੇ ਹਾਂ ਕਿ ਕੀ ਹੋ ਰਿਹਾ ਹੈ ਉਸ ਦੀ ਸ਼ੂਟਿੰਗ ਵੀ ਬਹੁਤ ਵਧੀਆ ਹੁੰਦੀ ਹੈ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇਗਜਾਮਪਲ ਦਿੰਦਾਂ ਹਾਂ ਜਿਸ ਨਾਲ ਤੁਹਾਨੂੰ ਇਹ ਸਹੀ ਸਾਬਿਤ ਹੋ ਜਾਏਗਾ ਕਿ ਡਰੋਨ ਨਾਲ ਸ਼ੂਟਿੰਗ ਬਹੁਤ ਹੀ ਵਧੀਆ ਹੋ ਗਈ ਹੈ ਉਹਦੀ ਵਜ੍ਹਾ ਇਹ ਹੈ ਕਿ ਪਹਿਲੇ ਦੇ ਜਮਾਨੇ ਵਿੱਚ ਜਦੋਂ ਫਿਲਮਾਂ ਸ਼ੂਟ ਹੁੰਦੀਆਂ ਸਨ ਉਦੋਂ ਉੱਪਰ ਦਾ ਸ਼ੂਟ ਲੈਣ ਵਾਸਤੇ ਹੈਲੀਕਾਪਟਰ ਦੀ ਮਦਦ ਨਾਲ ਸ਼ੂਟ ਲਿੱਤਾ ਜਾਂਦਾ ਸੀ ਜਿਸ ਵਿੱਚ ਬਹੁਤ ਹੀ ਜ਼ਿਆਦਾ ਖਰਚਾ ਆਉਂਦਾ ਸੀ ਪਰ ਅੱਜ ਕੱਲ੍ਹ ਉਹੀ ਚੀਜ਼ ਡਰੋਨ ਦੀ ਮਦਦ ਨਾਲ ਹੋਣ ਲੱਗ ਪਈ ਹੈ ਜਿਸ ਨਾਲ ਖਰਚਾ ਵੀ ਘੱਟ ਗਿਆ ਹੈ ਅਤੇ ਉਹਨਾਂ ਨੂੰ ਇਹ ਜ਼ਿਆਦਾ ਮਦਦਗਾਰ ਵੀ ਸਾਬਿਤ ਹੁੰਦਾ ਹੈ ਡਰੋਨ ਸਿਰਫ਼ ਇੱਕ ਰਿਮੋਟ ਨਾਲ ਕੰਟਰੋਲ ਹੋ ਜਾਂਦਾ ਹੈ ਨਾ ਹੀ ਉਹਦੇ ਉੱਤੇ ਜ਼ਿਆਦਾ ਪੈਸੇ ਲੱਗਦੇ ਹਨ ਨਾ ਹੀ ਕੋਈ ਪੈਟਰੋਲ ਦਾ ਖਰਚਾ ਆਉਂਦਾ ਹੈ ਉੱਤੇ ਹੀ ਦੂਸਰੇ ਬੰਨੇ ਜਿੱਥੇ ਹੈਲੀਕਾਪਟਰ ਨਾਲ ਸ਼ੂਟਿੰਗ ਹੁੰਦੀ ਸੀ ਉੱਥੇ ਸਾਨੂੰ ਪੈਟਰੋਲ ਦਾ ਖਰਚਾ ਵੀ ਕਰਨਾ ਪੈਂਦਾ ਸੀ ਅਤੇ ਖਰਚਾ ਵੀ ਬਹੁਤ ਜ਼ਿਆਦਾ ਆਉਂਦਾ ਸੀ ਇਸ ਕਰਕੇ ਇਹ ਦ੍ਰਿਸ਼ਟੀਕੋਣ ਵੇਖਣ ਦਾ ਤਰੀਕਾ ਸੰਸਾਰ ਨੂੰ ਬਦਲ ਦਿੰਦਾ ਹੈ ਧੰਨਵਾਦ